ਦਸਤ ਦੇ ਘਰੇਲੂ ਉਪਚਾਰਾਂ ਵਿੱਚ ਬਹੁਤ ਸਾਰਾ ਪਾਣੀ ਪੀਣਾ ਅਤੇ ਚਰਬੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਹੈ ਵੈਸੇ ਤਾਂ ਕਦੇ ਕਦੇ ਦਫਸ਼ ਆਪੇ ਹੀ ਠੀਕ ਹੋ ਜਾਂਦਾ ਹੈ ਪਰ ਕ ਕਿਸੇ ਵਿਅਕਤੀ ਦਾ ਅਗਰ ਠੀਕ ਨਾ ਹੋਵੇ ਤਾਂ ਉਸ ਨੂੰ ਡੋਕਟਰੀ ਸਲਾਹ ਵੀ ਲੈਣੀ ਚਾਹੀਦੀ ਹੈ ਜਾਂ ਜੇਕਰ ਕੋਈ ਹੋਰ ਲੱਛਣ ਹਨ ਦਸਤ ਤੋਂ ਇਲਾਵਾ